ਹਾਂਜੀ ਦੇਸ਼ ਤਾਂ ਨਹੀਂ ਲੇਕਿਨ ਮੈਂ ਰਾਜ ਕਾਫੀ ਘੁੰਮਿਆ ਮੇਰੇ ਫਾਦਰ ਦਾ ਬੈਕਗਰਾਊਂਡ ਆਰਮੀ 'ਚ ਸੀ ਅਤੇ ਇਸੇ ਕਰਕੇ ਵੱਖ ਵੱਖ ਜਗ੍ਹਾ 'ਤੇ ਪੋਸਟਿੰਗ ਹੋਣ ਕਰਕੇ ਮੈਂ ਕਾਫੀ ਰਾਜ ਘੁੰਮਿਆ ਜਿਵਾ ਜਿਵੇਂ ਮਹਾਰਾਸ਼ਟਰ ਘੁੰਮਿਆ ਹੋਇਆ ਰਾਜਸਥਾਨ ਹਰਿਆਣਾ ਦਿੱਲੀ ਫਿਰ ਅਸਮ ਅਤੇ ਉੱਤਰਾਖੰਡ ਰਹਿ ਚੁੱਕਿਆ ਮਤਲਬ ਪਹਿਲਾਂ ਤਾਂ ਜਦੋਂ ਬਚਪਨ 'ਚ ਸੀਗੇ ਤਾਂ ਉਦੋਂ ਤਾਂ ਕਾਫੀ ਬਿਲਕੁਲ ਰੁਚੀ ਨਹੀਂ ਸੀਗੀ ਕਿ ਬਾਰ ਬਾਰ ਆਪਣਾ ਸਕੂਲ ਚੇਂਜ ਕਰਨਾ ਆਪਣੇ ਦੋ ਸਾਈਡ ਅਤੇ ਕਿਤੇ ਬਾਰ ਬਾਰ ਵੱਖਰੀ ਵੱਖਰੀ ਜਗਹਾ 'ਤੇ ਜਾ ਕੇ ਉੱਥੇ ਨਵੇਂ ਦੋਸਤ ਬਣਾਉਣੇ ਇਹ ਕਾਫੀ ਮਤਲਬ ਮੁਸ਼ਕਿਲ ਚੀਜ਼ ਲੱਗਦੀ ਸੀਗੀ ਮੈਨੂੰ ਲੇਕਿਨ ਜਿਵੇਂ ਜਿਵੇਂ ਮਤਲਬ ਵੱਡੇ ਹੋਏ ਤਾਂ ਸਮਝ ਆਉਣਾ ਸ਼ੁਰੂ ਹੋਈ ਕਿ ਕਲਚਰ ਆਪਣਾ ਲਾਈਫ ਸਟਾਈਲ ਅਤੇ ਜਿੱਦਾਂ ਕਿ ਲੈਂਗੁਏਜੀਸ ਸਿੱਖਣ ਨੂੰ ਮਿਲਦੀਆਂ ਬਾਹਰ ਰਹਿ ਕੇ ਬਾਹਰ ਰਹਿ ਕੇ ਤੁਸੀਂ ਇੱਕ ਦੂਜੇ ਦਾ ਕਲਚਰ ਸਿੱਖਦੇ ਹੋ ਕਿਸੇ ਤੋਂ ਸਿੱਖਦੇ ਹੋ ਕਿਸੇ ਨੂੰ ਸਿਖਾਉਂਦੇ ਹੋ ਅਤੇ ਇਹ ਚੀਜ਼ ਕਾਫੀ ਐਕਸਪੀਰੀਅੰਸ ਅਤੇ ਤੁਹਾਡੀ ਲਾਈਫ 'ਚ ਕਾਫੀ ਇੰਪੋਰਟੈਂਟ ਹੁੰਦੀਆਂ ਨੇ ਅਤੇ ਇਹੀ ਚੀਜ਼ ਮੈਨੂੰ ਯਾਤਰਾ 'ਤੇ ਮੈਨੂੰ ਇਹੀ ਚੀਜ਼ ਕਾਫੀ ਪਸੰਦ ਹੈ ਕਿ ਤੁਸੀਂ ਕਾਫੀ ਕੁੱਝ ਸਿੱਖਦੇ ਹੋ ਯਾਤਰਾ ਕਰਕੇ ਅਤੇ ਹੁਣ ਮੇਰਾ ਉਦੇਸ਼ ਯਾਤਰਾ ਤੋਂ ਇਹੀ ਹੈ ਕਿ ਮੈਂ ਕਿਸੇ ਤੋਂ ਸਿੱਖਾਂ ਅਤੇ ਕਿਸੇ ਨੂੰ ਸਿਖਾਵਾਂ